ਮੇਰੀ ਮਨਪਸੰਦ ਕਿਤਾਬ ਹੈ ਚੈਂਡਲਰ ਲਿਸਟ ਜੋ ਕਿ ਉਨੀ ਸੌ ਤਰਤਾਲੀ ਵਿੱਚ ਆਈ ਸੀ ਇਹ ਕਿਤਾਬ ਹਿਟਲਰ ਬਾਰੇ ਹੈ ਕਿੱਦਾਂ ਹਿਟਲਰ ਨੇ ਆਪਣੇ ਰਾਜ ਦੌਰਾਨ ਯਹੂਦੀਆਂ 'ਤੇ ਹਮਲੇ ਕੀਤੇ ਕਿਵੇਂ ਉਹਨਾਂ ਦੇ ਤਸ਼ੱਦਦ ਢਾਏ ਅਤੇ ਉ ਉਹਨਾਂ ਦੇ ਸਟ੍ਰੱਗਲ ਯਹੂਦੀਆਂ ਦੇ ਸਟ੍ਰੱਗਲ ਬਾਰੇ ਦੱਸਿਆ ਗਿਆ ਹੈ ਅਤੇ ਇਸ ਕਿਤਾਬ ਤੋਂ ਸਾਨੂੰ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਜਿਵੇਂ ਕਿ ਸਾਨੂੰ ਦੂਸਰਿਆਂ ਦੀ ਹੈੱਲਪ ਕਰਨੀ ਚਾਹੀਦੀ ਹੈ ਕਿਵੇਂ ਇੱਕ ਇੱਕ ਕੈਪੀਟਲਿਸਟ ਨੇ ਆਪਣੇ ਆਪਣਾ ਪ੍ਰੋਫਿੱਟ ਦੇਖਦੇ ਹੋਏ ਅਤੇ ਨਾਲ ਦੀ ਨਾਲ ਹੈੱਲਪਿੰਗ ਬਾਰੇ ਸੋਚਦੇ ਹੋਏ ਲੱਖਾਂ ਯਹੂਦੀਆਂ ਨੂੰ ਹੈੱਲਪ ਕੀਤੀ ਉਹਨਾਂ ਨੂੰ ਕੰਮ ਕੰਮ ਦਿੱਤਾ ਫੈਕਟਰੀ ਵਿੱਚ ਅਤੇ ਉਹਨਾਂ ਦਾ ਇੰਨਕਮ ਇੰਨਕਮ ਰਿਸ੍ਰੋਸ ਉਹਨਾਂ ਲਈ ਪੈਦਾ ਕੀਤਾ ਇੱਦਾਂ ਉਹਨਾਂ ਦੀ ਹੈੱਲਪ ਵੀ ਹੋ ਗਈ ਅਤੇ ਉਹਨਾਂ ਨੂੰ ਹਿਟਲਰ ਤੋਂ ਬਚਾਇਆ ਵੀ ਇੱਕ ਫੈਕਟਰੀ ਵਿੱਚ ਰੱਖ ਕੇ ਅਤੇ ਹੋਰ ਫਿਰ ਸਿੱਖ ਸਕਦੇ ਹਾਂ ਇਸ ਤੋਂ ਕਿ ਸਾਨੂੰ ਜੋ ਜੋ ਵੀ ਹੋਇਆ ਇੰਨਾ ਮਾੜਾ ਕਿ ਹਿਟਲਰ ਨੇ ਕਾਫੀ ਲੱਖਾਂ ਹੀ ਯਹੂਦੀਆਂ ਨੂੰ ਇੱਕ ਇੱਕ ਵੱਡੇ ਜਿਹੇ ਗਰਾਊਂਡ ਵਿੱਚ ਜਿੰਦਾ ਜਲਾ ਤਾ ਸੀ ਅਤੇ ਇੰਨੇ ਮਾੜੇ ਈਵੈਂਟ ਨੂੰ ਸਾਨੂੰ ਹਿਸਟਰੀ ਦੇ ਈਵੈਂਟ ਨੂੰ ਨਹੀਂ ਭੁੱਲਣਾ ਚਾਹੀਦਾ ਹੋਰ ਆਪਾਂ ਸਿੱਖ ਸਕਦੇ ਹਾਂ ਕਿ ਸਾਨੂੰ ਭਾਵੇਂ ਬੰਦਾ ਜਿਹੜੇ ਮਰਜ਼ੀ ਧਰਮ ਦਾ ਹੋਵੇ ਜੈਂਡਰ ਦਾ ਹੋਵੇ ਕੋਈ ਵੀ ਡਿਫ਼ਰੈਸ ਦਾ ਹੋਵੇ ਸਾਨੂੰ ਉਹਨਾਂ 'ਚ ਭੇਦ ਭਾਵ ਨਹੀਂ ਕਰਨਾ ਚਾਹੀਦਾ ਸਭ ਨੂੰ ਬਰਾਬਰ ਮੰਨਣਾ ਚਾਹੀਦਾ ਹੈ ਅਤੇ ਹੋਰ ਇਸ ਇਸ ਵਿੱਚ ਇਹ ਵੀ ਸਿੱਖਣ ਵਾਲੀ ਗੱਲ ਹੈ ਕਿ ਕਿਵੇਂ ਇੱਕ ਬੰਦੇ ਦੀ ਪਾਵਰ ਕਿਵੇਂ ਦੁਨੀਆਂ ਨੂੰ ਚੇਜ਼ ਕਰ ਸਕਦੀ ਹੈ ਜਿਵੇਂ ਇੱਕ ਕੈਪੀਟਲਿਸਟ ਨੇ ਕਿਵੇਂ ਇੱਕ ਯਹੂਦੀਆਂ ਨੂੰ ਇੰਨਕਮ ਔਫ ਰਿਸ੍ਰੋਸ ਦਿੱਤਾ ਉਹਨਾਂ ਦੀ ਹੈੱਲਪ ਵੀ ਕੀਤੀ ਉਹਨਾਂ ਨੂੰ ਹਿਟਲਰ ਤੋਂ ਬਚਾਇਆ